ਹੈਲੋ ਤੁਸੀਂ ਸਰ ਮੂਸੇ ਮੂਸੇ ਆਲੇ ਬਾਰੇ ਨਾਂ ਸੁਣਿਆ ਹੋਊਗਾ ਅਸੀਂ ਜੀ ਉਹਨਾਂ ਬਾਰੇ ਜਾਣਕਾਰੀ ਹਾਸਿਲ ਕਰਨੀ ਸੀਗੀ ਤਾਂ ਮੈਂ ਮੀਡੀਆ ਰਿਪੋਰਟ ਹਾਂਜੀ ਹਾਂਜੀ ਮੈਂ ਮੀਡੀਆ ਰਿਪੋਰਟ ਤੋਂ ਬੋਲ ਰਿਹਾ ਮੈਂ ਉਹਨਾਂ ਬਾਰੇ ਡਾਟਾ ਇਕੱਠਾ ਕਰਨਾ ਗਾ ਅਤੇ ਤੁਸੀਂ ਮੈਨੂੰ ਉਹਨਾਂ ਬਾਰੇ ਜਾਣਕਾਰੀ ਦੱਸ ਸਕਦੇ ਹੋ ਕਿਵੇਂ ਕਿਵੇਂ ਉਹ ਐਨਾ ਛੋਟੇ ਪੱਧਰ ਤੋਂ ਉੱਠ ਕੇ ਐਨੇ ਵੱਡੇ ਵੱਡੇ ਪੱਧਰ 'ਤੇ ਗਿਆ ਕਿਵੇਂ ਗਿਆ ਉਹ ਕਿ ਉਹਦੀ ਮਿਹਨਤ ਸੀਗੀ ਕੀ ਉਹਦਾ ਉਹਨੇ ਕੀ ਕੁਛ ਕੀਤਾ ਆਪਣੀ ਲਾਈਫ ਦੇ ਵਿੱਚ ਦੱਸ ਸਕਦੇ ਹੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਅਸੀਂ ਦੇਖਦੇ ਰਹਿੰਦੇ ਹਾਂ ਮੀਡੀਆ ਦੇ ਵਿੱਚ ਵੀ ਖ਼ਬਰਾਂ ਦੇ ਵਿੱਚ ਵੀ ਕਿਵੇਂ ਉਹ ਅੱਡੇ ਵੱਡੇ ਸਿੰਗਰ ਹੋ ਕੇ ਵੀ ਖੇਤੀ ਨਾਲ ਆਪਣੇ ਪਿਛੋਕੜ ਨਾਲ ਜੁੜੇ ਹੋਏ ਸੀਗੇ ਹਾਂਜੀ ਹਾਂਜੀ ਉਹਨਾਂ ਨੇ ਇੰਜੀਨੀਅਰ ਕਰੀ ਹੋਈ ਸੀ ਹਾਂ ਹਾਂ ਹਾਂ ਹਾਂਜੀ ਹਾਂਜੀ

ਹਾਂ ਉਹ ਵੱਖਰਾ ਸੀਗਾ ਵੱਖਰਾ ਸੀਗਾ ਜੀ ਉਹ ਹਾਂਜੀ ਓਕੇ ਸਰ ਹੋਰ ਜਾਣਕਾਰੀ ਦੱਸਣਾ ਚਾਹੋਗੇ ਉਹਨਾਂ ਬਾਰੇ ਪਰਸਨੈਲਿਟੀ ਬਾਰੇ ਉਹ ਅਤੇ ਮੀਡੀਆ ਦੇ ਵਿੱਚ ਖ਼ਬਰਾਂ ਛਪ ਰਹੀਆਂ ਪਰ ਅਸੀਂ ਸੁਣਿਆ ਗਾ ਕਿਵੇਂ ਉਹ ਬਹੁਤ ਹੀ ਛੋਟੇ ਪਰਿਵਾਰ ਤੋਂ ਉੱਠ ਕੇ ਐਡੇ ਵੱਡੇ ਪਰਿਵਾਰ ਤੱਕ ਪਹੁੰਚੇ ਉਹਨਾਂ ਦਾ ਬੈਕਗਰਾਉਂਡ ਪਰਿਵਾਰ ਦਾ ਕੀ ਸੀਗਾ ਜੀ ਇਹ ਦੱਸ ਸਕਦੇ ਮਾੜਾ ਜਿਹਾ ਹਾਂਜੀ ਹਾਂਜੀ ਅਤੇ ਉਹਨਾਂ ਦਾ ਸਰ ਤੁਸੀਂ ਦੱਸ ਸਕਦੇ ਹੋ ਪਹਿਲਾਂ ਗਾਣਾ ਕਿਹੜਾ ਸੀਗਾ ਅਤੇ ਉਹ ਅਸੀਂ ਸੁਣਿਆ ਉਹ ਕਨੇਡਾ ਵੀ ਗਏ ਸੀ ਅਤੇ ਕਿਵੇਂ ਕੁਛ ਸੀਗਾ ਇਹਦੇ ਬਾਰੇ ਜਾਣਕਾਰੀ ਦੱਸ ਸਕਦੇ ਹੋ ਠੀਕ ਹੈ ਸਰ ਤਾਂ ਤੁਹਾਨੂੰ ਪਿੰਡ 'ਚ ਹਾਂ ਕੇ ਮਿਲਦੇ ਆ ਗੇ ਅਤੇ ਤੁਹਾਡੇ ਬਾਰੇ ਔਰ ਡਾਟਾ ਇਕੱਠਾ ਕਰਦੇ ਹਾਂ ਧੰਨਵਾਦ ਜੀ